ਪ੍ਰਵੇਸ਼ ਦੁਆਰਾ ਥਰੈਸ਼ਹੋਲਡ ਤੇ ਗੋਬਰ ਨੂੰ ਪਾਣੀ ਮਿਲਾ ਕੇ ਛਿੜਕ ਛਿੜਕਣ ਪਿੱਛੇ ਇਹ ਤਰਕ ਹੈ ਕਿ ਇਸ ਇਸ ਨੂੰ ਸਪਰੇਅ ਕਰਨ ਨਾਲ ਸਪਰੇਅ ਕੀਤੀ ਜਾਂਦੀ ਹੈ ਇਸ ਵਿੱਚ ਸੌਲ਼੍ਹਾਂ ਤੱਤ ਹੁੰਦੇ ਹਨ ਪੌਦੇ ਦਾ ਵਿਕਾਸ ਹੁੰਦਾ ਹੈ ਅਤੇ ਪੌਦੇ ਰੁਕੇ ਹੋਏ ਵੱਧਣੇ ਹੋਣ ਸ਼ੁਰੂ ਹੋ ਜਾਂਦੇ ਹਨ ਅਤੇ ਪੌਦੇ ਨੂੰ ਫਲ ਲੱਗਣਾ ਲੱਗਣ ਲੱਗ ਜਾਂਦਾ ਹੈ ਅਤੇ ਤੱਤਾਂ ਦੀ ਘਾਟ ਨੂੰ ਪੂਰੇ ਪੂਰਾ ਕਰਦਾ ਹੈ